ਮਹਾਤਮਾ ਗਾਂਧੀ ਜਵਾਹਰ ਲਾਲ ਨਹਿਰੂ ਡਾਕਟਰ ਰਜਿੰਦਰ ਪ੍ਰਸਾਦ ਪੀ ਟੀ ਊਸ਼ਾ ਦਿਆਨੰਦ ਸਰਸਵਤੀ ਪ੍ਰਿਅੰਕਾ ਚੋਪੜਾ ਆਲਿਆ ਭਟ ਵਰੁਨ ਧਵਨ ਸਲਮਾਨ ਖਾਨ ਸ਼ਾਹਰੁਖ ਖਾਨ ਅਜੇ ਦੇਵਗਨ